ਹੈਲੋ ਮਨਪ੍ਰੀਤ ਸਿੰਘ ਕੀ ਹਾਲ ਨੇ ਮੈਂ ਯਾਰ ਅੰਮ੍ਰਿਤਸਰ ਆਇਆ ਸੀ ਅਤੇ ਇੱਥੇ ਕਿਹੜੀ ਐਪ ਜਿਹੜੀ ਹੈ ਵਧੀਆ ਵੀ ਜਿਹੜੀ ਡਰਾਈਵਿੰਗ ਦੇ ਵਾਸਤੇ ਜਿਹੜੇ ਡਰਾਈਵਰ ਜਿਨ੍ਹਾਂ ਤੋਂ ਮਿਲ ਸਕਦੇ ਨੇ ਆਪਾਂ ਮੈਂ ਸਥਾਨਕ ਯਾਤਰਾ ਕਰਨਾ ਚਾਹੁੰਦਾ ਸੀ ਅਤੇ ਕੋਈ ਜਿਹੜੀ ਖ਼ਾਸ ਇੱਥੇ ਦੀ ਕੈਬ ਸੇਵਾ ਹੈ ਉਹ ਮੈਨੂੰ ਦੱਸੋ ਅੱਛਾ ਓਲਾ ਵਧੀਆ ਤਾਂ ਓਲਾ ਦੇ ਜਿਹੜੇ ਡਰਾਈਵਰ ਨੇ ਉਹਨਾਂ ਦੀ ਜਿਹੜੇ ਭੇਜਦੇ ਨੇ ਨਾਲ ਗੱਡੀ ਦੇ ਵਿੱਚ ਵਧੀਆ ਸੇਫ ਰਹਿੰਦੇ ਨੇ ਠੀਕ ਹੈ ਜੀ ਅਤੇ ਇਹ ਕਿੰਨੇ ਕੁ ਚਿਰ ਦੇ ਵਿੱਚ ਜਾਂ ਇਹਨਾਂ ਦੀ ਕੀਮਤ ਕੀ ਕੁਛ ਹੈ ਉਹਦੇ ਬਾਰੇ ਵੀ ਦੱਸੋ ਜੀ ਟਾਇਮ ਸਿਰ ਪਹੁੰਚ ਜਾਂਦੇ ਨੇ ਠੀਕ ਆ ਅਤੇ ਕੀਮਤ ਵੀ ਠੀਕ ਹੈ ਇਹਨਾਂ ਦੀ ਠੀਕ ਹੈ ਜੀ ਅਤੇ ਮੈਂ ਚਾਹੁੰਦਾ ਸੀ ਕਿ ਮੈਨੂੰ ਇਹਨਾਂ ਦੇ ਆਪਣਾ ਉਹ ਐਪ ਦਾ ਪੂਰਾ ਪ੍ਰੋਪਰ ਐਡਰੈਸ ਤੁਸੀਂ ਆਪਣੇ ਵਟਸਐਪ ਕਰ ਦਿਉ ਤਾਂ ਕਿ ਮੈਂ ਉਹਨਾਂ ਨੂੰ ਸੰਪਰਕ ਉਸ ਐਪ ਨੂੰ ਡਾਊਨਲੋਡ ਕਰਕੇ ਉਹਨਾਂ ਨਾਲ ਸੰਪਰਕ ਕਰ ਸਕਾਂ ਅਤੇ ਇਹ ਐਪ ਨੂੰ ਵਰਤਣਾ ਕਿਵੇਂ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਮੈਨੂੰ ਦੱਸ ਦਿਉ ਠੀਕ ਹੈ ਜੀ ਕਿ ਇਸ ਨੂੰ ਬਿਨਾਂ ਇੰਸਟੋਲ ਕਰਨਾ ਠੀਕ ਹੈ ਅਤੇ ਫਿਰ ਵਿੱਚ ਆਪਣਾ ਨਾਮ ਪਤਾ ਐਡਰੈਸ ਦੇ ਕੇ ਠੀਕ ਹੈ ਜੀ ਅਤੇ ਉਸ ਨੂੰ ਡਰਾਈਵਰ ਨੂੰ ਕਾਲ ਕਰ ਲੈਣੀ ਠੀਕ ਹੈ ਓਕੇ ਧੰਨਵਾਦ ਜੀ